ਮੈਂ ਇੱਕ ਪਿੰਡ ਵਿੱਚ ਰਹਿੰਦੀ ਹਾਂ ਅਤੇ ਕਲਾਕਾਰੀ ਮੇਰਾ ਸ਼ੌਂਕ ਆ ਪਰ ਕਈ ਵਾਰੀ ਮੈਨੂੰ ਇਹ ਸਮੱਸਿਆ ਆਉਂਦੀ ਕਿ ਮੈਂ ਕਲਾਕਾਰੀ ਨਾਲ ਸੰਬੰਧਿਤ ਸਮਾਨ ਜਿਵੇਂ ਬਰਸ਼ ਹੈ ਰੰਗ ਹੈ ਜਾਂ ਪੇਟਿੰਗ ਹੈ ਮੈਨੂੰ ਲਗਭਗ ਪੰਜ ਕਿਲੋਮੀਟਰ ਦੂਰ ਤੋਂ ਲਿਆਉਣੇ ਪੈਂਦੇ ਹੈ ਕਈ ਵਾਰੀ ਜਦੋਂ ਮੈਂ ਕੰਮ ਕਰਨ ਬੈਠਦੀ ਹਾਂ ਤਾਂ ਉਹ ਉਦੋਂ ਪਤਾ ਲੱਗਦਾ ਕਿ ਮੇਰੇ ਕੋਲ ਚੀਜ਼ ਉਹ ਨਹੀਂ ਹੈ ਜਿਹੜੀ ਮੈਨੂੰ ਚਾਹੀਦੀ ਹੁੰਦੀ ਹੈ ਸੋ ਉਸ ਟਾਈਮ ਮੇਰਾ ਫਿਰ ਟਾਈਮ ਵੇਸਟ ਹੁੰਦਾ ਕਿ ਮੈਨੂੰ ਉੱਠ ਕੇ ਜਾਣਾ ਪੈਣਾ ਜਾਂ ਲੈ ਕੇ ਆਉਣਾ ਪੈਣਾ ਤਾਂ ਕਈ ਵਾਰੀ ਉਹ ਇੱਕ ਦੋ ਦਿਨ ਡਿਲੇ ਵੀ ਹੋ ਜਾਂਦਾ ਹੈ ਹੋਰ ਘਰ ਦੇ ਕੰਮਾਂ ਕਾਰਾਂ ਦੇ ਵਿੱਚ ਸੋ ਇਹੋ ਜਿਹੇ ਮੁਸ਼ਕਿਲਾਂ ਆਉਂਦੀਆਂ ਹੈਗੀਆਂ ਅਤੇ ਕੋਸ਼ਿਸ਼ ਕਰੀਦੀ ਹੈ ਕਿ ਇਹਨਾਂ ਨੂੰ ਪਹਿਲਾਂ ਹੀ ਪੂਰਾ ਕੀਤਾ ਜਾਵੇ ਪਰ ਫਿਰ ਵੀ ਕਦੀ ਨਾ ਕਦੀ ਤਾਂ ਇਹ ਲੰਘਣਾ ਪੈਂਦਾ ਇਸ ਚੀਜ਼ ਦੇ ਵਿੱਚੋਂ